ਜੀ ਸ਼ੇਅਰ ਬਾਜ਼ਾਰ ਬਾਰੇ ਮੇਰਾ ਇਹੀ ਵਿਚਾਰ ਹੈ ਜਿਵੇਂ ਕਿ ਤੁਸੀਂ ਅੱਜ ਕੱਲ੍ਹ ਨਿਊਜ਼ ਚੈਨਲਾਂ 'ਤੇ ਸੁਣਿਆ ਹੋਵੇਗਾ ਕਿ ਲੋਕ ਜਾਂ ਫਿਰ ਛੋਟੀ ਉਮਰ ਦੇ ਬੱਚੇ ਖੁਦਕੁਸ਼ੀ ਕਰਦੇ ਹਨ ਅਸਲ ਵਿੱਚ ਉਹ ਗੱਲ ਇਹ ਹੈ ਕਿ ਉਹਨਾਂ ਨੂੰ ਸ਼ੇਅਰ ਬਾਜ਼ਾਰ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਇੱਕ ਦੂਜੇ ਤੋਂ ਪੈਸਾ ਫੜ ਕੇ ਸ਼ੇਅਰ ਬਾਜ਼ਾਰ ਉੱਤੇ ਲਾ ਦਿੰਦੇ ਹਨ ਜਿਸ ਦਾ ਹੱਲ ਇਹ ਹੁੰਦਾ ਹੈ ਵੀ ਉਹਨਾਂ ਨੂੰ ਵੱਧ ਤੋਂ ਵੱਧ ਪੈਸਿਆਂ ਦੇ ਨੁਕਸਾਨ ਹੁੰਦੇ ਹਨ ਅਤੇ ਉਹ ਉਸ ਨੁਕਸਾਨ ਨੂੰ ਪੂਰਾ ਕਰਨ ਲਈ ਸ਼ੇਅਰ ਬਾਜ਼ਾਰ 'ਤੇ ਹੋਰ ਵੀ ਪੈਸਾ ਲਾਉਂਦੇ ਹਨ ਜਿਸ ਕਰਕੇ ਉਹ ਕਰਜਾਈ ਹੋ ਜਾਂਦੇ ਹਨ ਅਤੇ ਆਪਣੀ ਖੁਦਕੁਸ਼ੀ ਕਰ ਲੈਂਦੇ ਹਨ ਜਿਸ ਕਰਕੇ ਮਾਂ ਪਿਓ ਨੂੰ ਇੰਨਾ ਦੁੱਖ ਪਹੁੰਚਦਾ ਹੈ ਜੀ ਸ਼ੇਅਰ ਬਾਜ਼ਾਰ ਵਾਲੇ ਤਾਂ ਬਹੁਤ ਹੀ ਅੱਜ ਕੱਲ ਇੰਟਰਨੈਟ ਤੇ ਐਪਲੀਕੇਸ਼ਨ ਚਾਲੂ ਹਨ ਜਿਵੇਂ ਕਿ ਅੱਪਸਟੋਕਸ ਲਿੰਕਡਇੰਨ ਐਕਸ ਹੋਰ ਵੀ ਨੇ ਜਿਵੇਂ ਕਿ ਤੁਸੀਂ ਵੇਖਿਆ ਹੀ ਹੋਵੇਗਾ ਜੀ ਇਹ ਖ਼ਤਰਨਾਕ ਉਦੋਂ ਸਾਬਿਤ ਹੁੰਦੇ ਹਨ ਜਦੋਂ ਤੁਹਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਾ ਹੋਵੇ ਜਾਂ ਤੁਸੀਂ ਇਹਦੇ ਬਾਰੇ ਪੜ੍ਹਿਆ ਲਿਖਿਆ ਨਾ ਹੋਵੇ ਜੇ ਤੁਹਾਨੂੰ ਇਸ ਬਾਰੇ ਕੋਈ ਵੀ ਨਿੱਜੀ ਐਕਸਪੀਰੀਐਂਸ ਨਾ ਹੋਵੇ ਤਾਂ ਕਰਕੇ ਤੁਸੀਂ ਇਸ ਵਿੱਚ ਫਸ ਵੀ ਸਕਦੇ ਹੋ ਇਸ ਨਾਲ ਬਚਿਆ ਵੀ ਜਾ ਸਕਦਾ ਹੈ ਜੇ ਤੁਸੀਂ ਆਪਣੇ ਦਿਮਾਗ ਤੋਂ ਕੰਮ ਲਓ ਅੱਜ ਕੱਲ੍ਹ ਫਰੋਡ ਕੋਲਾਂ ਵੀ ਆਉਂਦੀਆਂ ਹਨ ਜਿਸ ਕਰਕੇ ਲਿੰਕ ਉੱਪਰ ਜੇ ਤੁਸੀਂ ਹਲਕਾ ਜਿਹਾ ਵੀ ਕਲਿੱਕ ਕਰ ਦਿਉਂਗੇ ਤਾਂ ਤੁਹਾਡੀਆਂ ਸਾਰੀਆਂ ਸੂਚਨਾਵਾਂ ਨਿੱਜੀ ਸੂਚਨਾਵਾਂ ਉਹਨਾਂ ਕੋਲ ਪਹੁੰਚ ਜਾਂਦੀ ਹੈ ਅਤੇ ਤੁਹਾਡੇ ਬੈਂਕ ਅਕਾਊਂਟ ਵਿੱਚੋਂ ਪੈਸਾ ਉਹ ਕੱਢ ਲੈਂਦੇ ਹਨ ਜਿਸ ਕਰਕੇ ਤੁਹਾਨੂੰ ਇਹ ਬਹੁਤ ਨੁਕਸਾਨ ਹੁੰਦਾ ਹੈ ਅਤੇ ਆਪਣੀ ਪਰਸਨਲ ਅਤੇ ਜਿਹੜੀਆਂ ਨਿੱਜੀ ਜਾਣਕਾਰੀਆਂ ਹਨ ਉਹਨਾਂ ਨੂੰ ਨਾ ਸ਼ੇਅਰ ਕਰਿਆ ਕਰੋ ਧੰਨਵਾਦ